ਦੋ ਅਕਤੂਬਰ ਅਠਾਰਾਂ ਸੌ ਉਣੱਤਰ ਤੀਹ ਦਿਸੰਬਰ ਅਠਾਰਾਂ ਸੌ ਪਚਾਸੀ ਤੀਹ ਮਾਰਚ ਉੱਨੀ ਸੌ ਛੇ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ